ਕੁਝ ਰਵਾਇਤੀ ਪੰਜਾਬੀ ਭੰਗੜਾ ਅਤੇ ਸੰਗੀਤਕ ਸਾਜ਼ ਉਹ ਹੁੰਦੇ ਨੇ ਜੋ ਭੰਗੜਾ ਪਾਉਣ ਵੇਲੇ ਵਰਤੇ ਜਾਂਦੇ ਹਨ ਇਹਨਾਂ ਵਿੱਚੋਂ ਕੁਝ ਕੁ ਹਨ ਢੋਲ ਚਿਮਟਾ ਅਲਗੋਜ਼ੇ ਬੁਘਚੂ ਗਾਗਰ ਖੜਤਾਲ ਤੂੰਬੀ ਆਦਿ ਚਿਮਟਾ ਲੋਹੇ ਦਾ ਬਣਿਆ ਹੁੰਦਾ ਅਤੇ ਭੰਗੜੇ ਅਤੇ ਗੁਰਬਾਣੀ ਦੇ ਕੀਰਤਨ ਵਾਸਤੇ ਵਰਤਿਆ ਜਾਂਦਾ ਹੈ ਅਲਗੋਜ਼ੇ ਦੋ ਬੰਸਰੀਆਂ ਦੀ ਤਰ੍ਹਾਂ ਹੁੰਦੇ ਨੇ ਮੂੰਹ ਵਿੱਚੋਂ ਫੂਕ ਮਾਰ ਕੇ ਵਜਾਏ ਜਾਂਦੇ ਨੇ ਬੁਘਚੂ ਦੇਖਣ ਨੂੰ ਤਾਂ ਡਮਰੂ ਦੀ ਤਰ੍ਹਾਂ ਹੀ ਲੱਗਦਾ ਪਰ ਹੱਥਾਂ ਨਾਲ ਵਜਾਇਆ ਜਾਂਦਾ

ਇਹ ਲੱਕੜ ਦਾ ਬਣਿਆ ਹੁੰਦਾ ਹੈ ਅਤੇ ਦੋਵਾਂ ਪਾਸੇ ਸੋਟੀ ਮਾਰ ਸੋਟੀਆਂ ਮਾਰ ਕੇ ਵਜਾਇਆ ਜਾਂਦਾ ਹੈ ਇਹ ਮਨ ਵਿੱਚ ਖੇੜਾ ਲੈ ਕੇ ਆਉਂਦਾ ਹੈ ਅਤੇ ਪੈਰ ਬਦੋਬਦੀ ਨੱਚਣ ਲਈ ਤਿਆਰ ਹੋ ਜਾਂਦੇ ਨੇ ਗਾਗਰ ਗਾਗਰ ਪਿੱਤਲ ਦੀ ਹੁੰਦੀ ਹੈ ਅਤੇ ਦੋਵਾਂ ਹੱਥਾਂ ਵਿੱਚ ਮੁੰਦਰੀਆਂ ਪਾ ਕੇ ਇਸਨੂੰ ਵਜਾਇਆ ਜਾਂਦਾ ਹੈ ਘੜਾ ਘੜਾ ਵੀ ਗਾਗਰ ਦੀ ਤਰ੍ਹਾਂ ਹੀ ਦੋਵੇਂ ਹੱਥਾਂ ਵਿੱਚ ਮੁੰਦਰੀਆਂ ਪਾ ਕੇ ਵਜਾਇਆ ਜਾਂਦਾ ਹੈ ਕਾਟੋ ਇਹ ਸੋਟੀ ਦੇ ਉੱਤੇ ਕਾਟੋ ਲੱਗੀ ਹੁੰਦੀ ਹੈ ਜਿਸ ਨੂੰ ਕਿ ਰੱਸੀ ਖਿੱਚ ਕੇ ਵਜਾਇਆ ਜਾਂਦਾ ਹੈ ਇਕਤਾਰਾ ਇੱਕ ਤਾਰ ਦਾ ਬਣਿਆ ਹੋਇਆ ਇਹ ਇੱਕ ਉਂਗਲ ਨਾਲ ਹੀ ਵਜਾਇਆ ਜਾਂਦਾ ਹੈ ਖੜਤਾਲ ਖੜਤਾਲ ਦਾ ਮਤਲਬ ਹੈ ਹੱਥ ਅਤੇ ਤਾਲ ਦਾ ਮਤਲਬ ਹੈ ਤਾੜੀ ਇਸਨੂੰ ਦੋਵੇਂ ਹੱਥਾਂ ਵਿੱਚ ਫੜ ਕੇ ਵਜਾਇਆ ਜਾਂਦਾ ਹੈ